ਨਹੀਂ ਜੀ ਵੈਸੇ ਤਾਂ ਮੈਂ ਕੋਈ ਰਚਨਾਤਮਕ ਲਿਖਣ ਦਾ ਕੋਰਸ ਨਹੀਂ ਕੀਤਾ ਹੈ ਪਰ ਬਹੁਤ ਵਾਰ ਮੈਂ ਆਪਣੀ ਕਾਪੀਆਂ ਵਿੱਚ ਲਿਖ ਲੈਂਦੀ ਹਾਂ ਅਤੇ ਉਸ ਵਿੱਚ ਵਿਆਕਰਣ ਅਤੇ ਬਣਤਰ ਨਾਲ ਨਾਲ ਲਿਖਣ ਦੇ ਰਚਨਾਤਮਕ ਪੱਖ ਦਾ ਸੰਤੁਲਨ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਵਿਆਕਰਣ ਇੱਕ ਨਿਯਮਾਂ ਦੇ ਅਨੁਸਾਰ ਸ਼ਬਦ ਇੱਕ ਸ਼ੁੱਧ ਸ਼ੁੱਧ ਅਰਥ ਹੈ ਅਤੇ ਅਤੇ ਸਾਨੂੰ ਲਿਖਣ ਵੇਲੇ ਇਸ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਵੇਂ ਮੈਂ ਸੌਂ ਰਹੀ ਹਾਂ ਜਾਂ ਮੈਂ ਕੱਲ੍ਹ ਬਾਜ਼ਾਰ ਜਾਣਾ ਹੈ ਆਦਿ ਸਾਨੂੰ ਵਿਆਕਰਣ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਵਿਆਕਰਣ ਵੀ ਸ਼ਬਦ ਬੋਧ ਅਰਥ ਬੋਧ ਵਚਨ ਬੋਧ ਲਿੰਗ ਬੋਧ ਇਹ ਸਭ ਕੁਛ ਹੈ ਅਤੇ ਕੋਈ ਇੱਕ ਲਿੰਗ ਇੱਕ ਇਸਤਰੀ ਲਿੰਗ ਪੁਲਿੰਗ ਇੱਕ ਵਚਨ ਵਚਨ ਵਿਸ਼ੇਸ਼ਣ ਆਦਿ ਹੁੰਦਾ ਹੈ ਇਸ ਲਈ ਰਚਨਾਤਮਕ ਲਿਖਣ ਲਈ ਵਿਆਕਰਣ ਅਤੇ ਬਣਤਰ ਦਾ ਸੰਤੁਲਨ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਗੋਰੀ ਬਹੁਤ ਸੋਹਣੀ ਹੈ ਇਸ ਵਿੱਚ ਗੋਰੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਬਹੁਤ ਸੋਹਣੀ ਹੈ